ਨਮਸਕਾਰ ਜੀ ਤੁਹਾਡੇ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਸਾਨੂੰ ਸਾਡੇ ਧਰਮਾਂ ਵਿੱਚ ਸੈਰ ਸਪਾਟੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਤਾਂ ਕਿ ਪ੍ਰਭਾਵਿਤ ਅਸੀਂ ਇਸ ਕਰਕੇ ਕਰਦੇ ਹਾਂ ਸਾਡੇ ਕਈ ਪੰਜਾਬ ਵਿੱਚ ਕਈ ਐਸੀਆਂ ਥਾਵਾਂ ਹੁੰਦੀਆਂ ਨੇ ਕਿ ਜੋ ਘੁੰਮਣ ਫਿਰਨ ਨੂੰ ਬਹੁਤ ਸਾਰੀਆਂ ਹੁੰਦੀਆਂ ਜੋ ਕਿ ਸਾਡੇ ਬਾਹਰ ਦੇ ਲੋਕ ਵੀ ਸਾਡੇ ਇੱਧਰ ਘੁੰਮਣ ਨੂੰ ਆਉਂਦੇ ਹਨ ਜਿਵੇਂ ਵੈਸ਼ਨੋ ਦੇਵੀ ਦੀ ਯਾਤਰਾ ਵੈਸ਼ਨੋ ਮਾਤਾ ਦੀ ਯਾਤਰਾ ਹੋ ਗਈ ਹੋਰ ਵੀ ਕਿਤੇ ਬਰਿੰਦਾਵਨ ਕਈ ਮਤਲਬ ਕਈ ਥਾਵਾਂ 'ਤੇ ਸਾਨੂੰ ਯਾਤਰਾ ਕਰਨੀਆਂ ਚਾਹੀਦੀਆਂ ਹਨ ਕਿ ਦੇਸ਼ ਭਰ ਦੇ ਲੋਕ ਆਉਂਦੇ ਹਨ ਉੱਥੇ ਬਹੁਤ ਸਾਰੀਆਂ ਵੇਖਣ ਨੂੰ ਮਿਲਦੀਆਂ ਜਗ੍ਹਾ ਮਿਲਦੀਆਂ ਸਾਨੂੰ ਸਾਡੇ ਜੋ ਵੀ ਸਾਨੂੰ ਬਾਹਰੋਂ ਆਉਂਦੇ ਆ ਸਾਡੇ ਸਾਰੇ ਘੁੰਮਣ ਨੂੰ ਜਾਂਦੇ ਹਨ ਕਿ ਅਸੀਂ ਵੈਸ਼ਨੋ ਮਾਤਾ ਦੇ ਜਾਣਾ ਜਾਂ ਕਿਤੇ ਵੀ ਜਾਣਾ ਇਹ ਜਿਵੇਂ ਗੋਲਡਨ ਟੈਂਪਲ ਹੋ ਗਿਆ ਉੱਥੇ ਹਰ ਪ੍ਰਕਾਰ ਦੀ ਦੁਨੀਆ ਆਉਂਦੀ ਹੈ ਭਰ ਦੇ ਦੇਸ਼ ਭਰ ਦੇ ਲੋਕ ਆਉਂਦੇ ਆ ਜਿ ਹਰ ਪ੍ਰਕਾਰ ਦੇ ਲੋਕ ਆਉਂਦੇ ਆ ਫਿਰ ਵੈਸ਼ਨੋ ਮਾਤਾ ਚਿੰਤਪੁਰਨੀ ਬਰਿੰਦਾਵਨ ਹਰ ਇੱਕ ਇੱਕ ਧਰਮ ਦੇ ਮਤਲਬ ਹਰ ਇੱਕ ਜਾਤ ਪਾਤ ਜਾਂ ਕੁਛ ਵੀ ਹੁੰਦਾ ਸਾਰੇ ਲੋਕ ਆਉਂਦੇ ਆ ਸਾਡੇ ਸੈਰ ਸਪਾਟੇ ਕਰਦੇ ਹਨ ਫੁੱਲ ਇੰਜੋਏ ਕਰਦੇ ਹਨ ਘੁੰਮ ਫਿਰ ਕੇ ਆਪਣੇ ਮਨ ਨੂੰ ਪ੍ਰਭਾਵਿਤ ਕਰਦੇ ਹਨ ਆਪਣਾ ਮਤਲਬ ਘੁੰਮਣ ਵਿੱਚ ਕਾਫੀ ਸਾਰਾ ਸੈਰ ਸਪਾਟਾ ਹੋ ਜਾਂਦਾ ਤਾਂ ਕਿ ਅਸੀਂ